ਪੰਜ ਜੂਨ ਉੱਨੀ ਸੌ ਚੁਰਾਸੀ ਸਤਾਰ੍ਹਾਂ ਜੁਲਾਈ ਉੱਨੀ ਸੌ ਅਠਾਸੀ ਪੰਦਰ੍ਹਾਂ ਜੁਲਾਈ ਉੱਨੀ ਸੌ ਸਤਾਸੀ ਸਤਾਰ੍ਹਾਂ ਜਨਵਰੀ ਉੱਨੀ ਸੌ ਨੱਬੇ ਬਾਰ੍ਹਾਂ ਜੂਨ ਦੋ ਹਜ਼ਾਰ ਦਸ